ਗਾਇਕੀ ਵਿੱਚ ਭਾਵਨਾਵਾਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਉਹ ਇੱਕ ਗਾਇਕ ਦੀ ਗੁਣਵੱਤਾ ਅਤੇ ਪ੍ਰਗਟਾਵੇ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ ਉਹਨਾਂ ਨੂੰ ਭਾਵਨਾਵਾਂ ਨੂੰ ਵਿਅਕਤ ਕਰਨ ਅਤੇ ਬੋਲਣਾ ਅਤੇ ਸੁਰਾਂ ਵਿੱਚ ਨਿੱਜੀ ਭਾਵਨਾ ਨੂੰ ਸ਼ਾਮਿਲ ਕਰਕੇ ਦਰਸ਼ਕਾਂ ਨਾਲ ਡੂੰਘੇ ਪੱਧਰ 'ਤੇ ਜੁੜਨ ਦੀ ਆਗਿਆ ਦਿੰਦੀਆਂ ਹਨ ਅਸਲ ਵਿੱਚ ਭਾਵਨਾਵਾਂ ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਵੋਕਲ ਪ੍ਰਦਰਸ਼ਨ ਬਣਾਉਣ ਵਿੱਚ ਇੱਕ ਮੁੱਖ ਤੱਤ ਹਨ ਗਾਇਕੀ ਵਿੱਚ ਭਾਵਨਾਵਾਂ ਦੀ ਭੂਮਿਕਾ ਬਾਰੇ ਮੁੱਖ ਨੁਕਤੇ ਹਨ ਜਿਵੇਂ ਕਿ ਵੋਕਲ ਗੁਣਵੱਤਾ ਸਕਾਰਾਤਮਕ ਭਾਵਨਾਵਾਂ ਇੱਕ ਚਮਕਦਾਰ ਵਧੇਰੇ ਗੂੰਝ ਦੀ ਆਵਾਜ਼ ਵੱਲ ਲੈ ਜਾ ਸਕਦੀਆਂ ਹਨ ਜੋ ਕਿ ਨਕਾਰਾਤਮਕ ਭਾਵਨਾਵਾਂ ਇੱਕ ਗੂੜ੍ਹਾ ਸੁਰ ਪੈਦਾ ਕਰ ਸਕਦੀਆਂ ਹਨ ਵਕਾਂਸ਼ ਅਤੇ ਗਤੀਸ਼ੀਲਤਾ ਭਾਵਨਾਵਾਂ ਇਸ ਗੱਲ ਦਾ ਮਾਰਗਦਰਸ਼ਨ ਕਰਦੀਆਂ ਹਨ ਕਿ ਇੱਕ ਗਾਇਕ ਕਿਵੇਂ ਲਾਈਨਾਂ ਨੂੰ ਵਾਕਾਂਸ਼ ਕਰਦਾ ਹੈ ਅਤੇ ਆਵਾਜ਼ ਨੂੰ ਵਿਵਸਥਿਤ ਕਰਦਾ ਹੈ ਇੱਕ ਗੀਤ ਦੇ ਭਾਵਨਾਤਮਕ ਚਾਪ ਨੂੰ ਵਿਅਕਤ ਕਰਨ ਲਈ ਕੁਝ ਸ਼ਬਦਾਂ ਜਾਂ ਭਾਗਾਂ 'ਤੇ ਜ਼ੋਰ ਦਿੰਦਾ ਹੈ ਇੱਕ ਗਾਇਕ ਦਾ ਬੋਲਾਂ ਅਤੇ ਉਹਨਾਂ ਦੁਆਰਾ ਪੈਦਾ ਕੀਤੀਆਂ ਗਈਆਂ ਭਾਵਨਾਵਾਂ ਨਾਲ ਨਿੱਜੀ ਸੰਬੰਧ ਗੀਤ ਦੀ ਇੱਕ ਵਿਲੱਖਣ ਵਿਆਖਿਆ ਦਿੰਦਾ ਹੈ ਧੰਨਵਾਦ